ਮੈਂ ਸਭ ਤੋਂ ਪਹਿਲਾਂ ਡਰਾਇੰਗ ਆਪਣੇ ਬਚਪਨ ਵਿੱਚ ਸ਼ੁਰੂ ਕੀਤੀ ਸੀ ਮੈਂ ਉਸ ਦੌਰਾਨ ਬਹੁਤ ਛੋਟੀ ਹੋਇਆ ਕਰਦੀ ਸੀ ਮੰਨੋ ਕਿ ਪੰਜ ਕੁ ਸਾਲ ਦੀ ਮੇਰੀ ਮਾਤਾ ਜੀ ਨੂੰ ਵੀ ਡਰਾਇੰਗ ਦਾ ਬਹੁਤ ਸ਼ੌਂਕ ਸੀ ਉਹ ਵੀ ਘਰ ਵਿੱਚ ਡਰਾਇੰਗਸ ਕਰਦੇ ਰਹਿੰਦੇ ਸੀ ਉਹਨਾਂ ਨੂੰ ਕ੍ਰਾਫਟ ਦਾ ਵੀ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਸਾਰਾ ਘਰ ਕਰਾਫਟ ਅਤੇ ਡਰਾਇੰਗ ਨਾਲ ਸਜਾਇਆ ਹੁੰਦਾ ਸੀ ਤਾਂ ਮੈਨੂੰ ਵੀ ਉਹ ਦੇਖ ਕੇ ਪ੍ਰੇਰਨਾ ਮਿਲੀ ਕਿ ਇਸ ਨਾਲ ਘਰ ਤਾਂ ਬਹੁਤ ਸੋਹਣਾ ਲੱਗਦਾ ਹੈ ਤਾਂ ਮੈਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ ਅਤੇ ਜਦੋਂ ਮੈਂ ਸ਼ੁਰੂ ਸ਼ੁਰੂ 'ਚ ਸ਼ੁਰੂ ਕੀਤਾ ਤਾਂ ਉਸ ਟਾਈਮ ਮੇਰੀਆਂ ਹਰ ਰੇਖਾਵਾਂ ਨਹੀਂ ਸਹੀ ਹੁੰਦੀਆਂ ਸੀ ਪਰ ਮੇਰੀ ਮਾਤਾ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਹਰ ਤਰੀਕੇ ਨਾਲ ਹਰ ਤਰ੍ਹਾਂ ਦੇ ਕਲਰਸ ਲਿਆ ਕੇ ਮੇਰਾ ਹਰ ਰੋਜ਼ ਅਭਿਆਸ ਕਰਵਾਇਆ ਤਾਂ ਕਿ ਮੈਨੂੰ ਇੰਨਾ ਕੁ ਸ਼ੌਂਕ ਹੋ ਗਿਆ ਕਿ ਮੈਂ ਉਸ ਨੂੰ ਆਪਣੀ ਇੱਕ ਹੋਬੀ ਬਣਾ ਲਈ ਸੀ ਮੈਂ ਸਕੂਲ 'ਚ ਵੀ ਕੰਪੀਟੀਸ਼ਨ 'ਚ ਭਾਗ ਲੈਣ ਲੱਗ ਗਈ ਅਤੇ ਉਹਦੇ ਵਿੱਚ ਮੈਂ ਫਸਟ ਪ੍ਰਾਈਜ ਲਿਆਉਂਦੀ ਰਹੀ ਮੈਨੂੰ ਡਰਾਇੰਗ ਵਿੱਚ ਕਾਫ਼ੀ ਪ੍ਰਾਈਜ ਮਿਲੇ ਸੀ ਅਤੇ ਮੈਨੂੰ ਮੇਰੀ ਇਹ ਪ੍ਰੇਰਨਾ ਮੇਰੀ ਮਾਤਾ ਜੀ ਤੋਂ ਮਿਲੀ ਸੀ ਅਤੇ ਮੈਂ ਸਭ ਉਹਨਾਂ ਦੀ ਹੀ ਦੇਣ ਤੋਂ ਸਿੱਖਿਆ ਸੀ